ਭੰਗੜੇ ਦੀ ਮਹੱਤਤਾ ਭੰਗੜਾ ਡਾਂਸ ਤੋਂ ਵੀ ਵੱਧ ਕੇ ਹੈ ਇਹ ਪੰਜਾਬ ਵਿੱਚ ਪਾਇਆ ਜਾਂਦਾ ਹੈ ਭੰਗੜੇ ਵਿੱਚ ਅਸੀਂ ਅੱਡ ਅੱਡ ਤਰ੍ਹਾਂ ਦੇ ਸਟੈਪ ਕਰਦੇ ਹਾਂ ਇਹਦੇ ਨਾਲ ਆ ਸਾਡੇ ਹੱਥਾਂ ਪੈਰਾਂ ਦੀ ਮੂਵਮੈਂਟ ਵੀ ਹੁੰਦੀ ਹੈ ਜਿਹੜੇ ਲੋਕ ਭੰਗੜਾ ਪਾਉਂਦੇ ਹੈ ਉਹਦੇ ਉਹ ਫੇਸ ਐਕਸਪਰੈਸ਼ਨ ਦਿੰਦੇ ਹੈ ਉਹਦੇ ਨਾਲ ਉਹਨਾਂ ਦੇ ਫੇਸ ਦੀ ਐਕਸਰਸਾਈਜ਼ ਵੀ ਹੁੰਦੀ ਹੈ ਜਿਹਦੇ ਕਰਕੇ ਉਹਨਾਂ ਦਾ ਫੁੱਲ ਬਾਡੀ ਵਰਕਆਊਟ ਹੋ ਜਾਂਦਾ ਹੈ ਇਹਦੇ ਤੋਂ ਇਲਾਵਾ ਭੰਗੜੇ ਦਾ ਹੋਰ ਵੀ ਫਾਇਦਾ ਜਿਵੇਂ ਕਿ ਵੇਟ ਲੋਸ ਕਰਨਾ ਅਤੇ ਕੈਲਰੀਜ ਬਰਨ ਕਰਨਾ ਅਤੇ ਆਪਣੇ ਸਰੀਰ ਦੇ ਵੇਟ ਨੂੰ ਮੈਨੇਜ ਕਰਨਾ ਭੰਗੜਾ ਸਿਰਫ ਪੰਜਾਬ ਹੀ ਨਹੀਂ ਅੱਜ ਦੇ ਟਾਈਮ ਵਿੱਚ ਦੁਨੀਆ ਭਰ ਵਿੱਚ ਹੀ ਪਾਇਆ ਜਾਂਦਾ ਹੈ ਜਿਵੇਂ ਕਿ ਯੂ ਕੇ ਕਨੇਡਾ ਅਮੇਰੀਕਾ ਜਿਹਦੇ ਕਰਕੇ ਅਲੱਗ ਅਲੱਗ ਜਾਤਾਂ ਦੇ ਲੋਕ ਇਕੱਠੇ ਹੋ ਕੇ ਭੰਗੜਾ ਕਰਦੇ ਹੈ ਭੰਗੜਾ ਜਿਹੜੇ ਭੰਗੜਾ ਡਾਂਸਰ ਹੈ ਉਹ ਨੈਸ਼ਨਲ ਤੋਂ ਇੰਟਰਨੈਸ਼ਨਲ ਲੈਵਲ 'ਤੇ ਭੰਗੜਾ ਪਾਉਂਦੇ ਆ ਭੰਗੜਾ ਪਰਫੋਰਮ ਕਰਦੇ ਆ ਜਾੰ ਜਿ ਜਿਸ ਕਰਕੇ ਸਾਡੇ ਪੰਜਾਬ ਦਾ ਲੋਕ ਨਾਚ ਦੁਨੀਆ ਭਰ ਵਿੱਚ ਬਹੁਤ ਮਸ਼ਹੂਰ ਹੈ ਜਿਹੜੇ ਜਿਵੇਂ ਬਾਹਰ ਅੰਗਰੇਜ਼ ਹੈ ਉਹ ਵੀ ਆਪਦੇ ਅੰਗਰੇਜ਼ੀ ਗਾਣਿਆਂ 'ਤੇ ਭੰਗੜਾ ਪਰਫੋਰਮ ਕਰਦੇ ਹੈ ਇਸ ਕਰਕੇ ਭੰਗੜਾ ਪੂਰੀ ਦੁਨੀਆ ਵਿੱਚ ਹੀ ਬਹੁਤ ਜ਼ਿਆਦਾ ਮਸ਼ਹੂਰ ਹੈ